ਮੇਰੀ ਮਨਪਸੰਦ ਬਾਈਕ ਸਕੂਟਰੀ ਹੈ ਜਿਸਦੀ ਮੈਂ ਮਾਲਕ ਹਾਂ ਸਕੂਟਰੀ ਦੀ ਮੇਰੀ ਡਰੀਮ ਬਾਈਕ ਵੀ ਸਕੂਟਰੀ ਹੀ ਹੈ ਮੈਂ ਰੋਜ਼ ਉਸਨੂੰ

ਪੈਟਰੋਲ ਡੀਜ਼ਲ ਵਾਲੀ ਅਤੇ ਬਿਜਲੀ ਵਾਲੀਆਂ ਵੀ ਆਉਂਦੀਆਂ ਹਨ ਪਰ ਮੇਰੇ ਕੋਲ ਪੈਟਰੋਲ ਵਾਲੀ ਹੈ ਜਿਸ ਨਾਲ ਕੋਈ ਦਿੱਕਤ ਨਹੀਂ ਆਉਂਦੀ ਅਤੇ ਇਹ ਮੇਰੀ ਮਨਪਸੰਦ ਅਤੇ ਮੇਰੀ ਡਰੀਮ ਬਾਈਕ ਹੈ ਜਿੱਥੇ ਵੀ ਜਾਂਦੀ ਹਾਂ ਮੈਂ ਇਹਨੂੰ ਵੀ ਲੈ ਕੇ ਜਾਂਦੀ ਹਾਂ ਬਹੁਤ ਜ਼ਿਆਦਾ ਜ਼ਰੂਰ ਮ ਜ਼ ਅੱਜ ਕੱਲ ਲਈ ਬਹੁਤ ਜ਼ਿਆਦਾ ਇਹ ਇੱਕ ਆਉਣ ਜਾਣ ਦਾ ਜ਼ਰੀਆ ਵਧੀਆ ਹੈ ਅਤੇ ਕਿਤੇ ਵੀ ਆ ਜਾ ਸਕਦੇ ਹਾਂ ਵਧੀਆ ਤਰੀਕੇ ਨਾਲ ਕਿਸੇ ਦੀ ਕੋਈ ਵੇਟ ਨਹੀਂ ਕਰਨੀ ਪੈਂਦੀ ਕੋਈ ਕੁਛ ਨਹੀਂ ਬਹੁਤ ਹੀ ਜ਼ਿਆਦਾ ਵਧੀਆ ਇੱਕ ਬਾਈਕ ਹੈ ਮੇਰੇ ਲਈ ਇਹ ਬਹੁਤ ਹੀ ਵਧੀਆ ਹੈ ਅਤੇ ਕਿਤੇ ਵੀ ਮੈਂ ਆ ਜਾ ਸਕਦੀ ਹਾਂ ਆਰਾਮ ਨਾਲ